ਆਜ਼ਾਦੀ ਦੀਆਂ ਘਟਨਾਵਾਂ ਬਾਰੇ ਮੈਨੂੰ ਬਹੁਤਾ ਜਾਣਕਾਰੀ ਨਹੀਂ ਹੈ ਕਿਉਂਕਿ ਮੈਂ ਇੱਕ ਕਿਸਾਨ ਹਾਂ ਪਰ ਫਿਰ ਵੀ ਮੈਂ ਗਾਂਧੀ ਜੀ ਬਾਰੇ ਸ਼ਹੀਦ ਭਗਤ ਸਿੰਘ ਜੀ ਬਾਰੇ ਰਾਜਗੁਰੂ ਜੀ ਬਾਰੇ ਅਤੇ ਚੰਦਰ ਸ਼ੇਖਰ ਅਜਾਦ ਜੀ ਬਾਰੇ ਬਹੁਤ ਕੁਝ ਸੁਣਿਆ ਹੈ ਉਹਨਾਂ ਨੇ ਆਜਾਦੀ ਦੇ ਸੰਘਰਸ਼ ਲਈ ਬਹੁਤ ਕੁਝ ਕੀਤਾ ਹੈ ਗਾਂਧੀ ਜੀ ਨੇ ਵੱਖ ਵੱਖ ਅੰਦੋਲਨ ਚਲਾਏ ਸੀ ਜਿਵੇਂ ਦਾਂਡੀ ਮਾਰਚ ਸੱਤਿਆਗ੍ਰਹਿ ਇਸ ਤਰ੍ਹਾਂ ਇਸ ਤਰ੍ਹਾਂ ਗਾਂਧੀ ਜੀ ਨੇ ਬਹੁਤ ਸਾਰੇ ਅੰਦੋਲਨ ਚਲਾਏ ਆ ਅਤੇ ਨਾਲ ਹੀ ਸ਼ਹੀਦ ਭਗਤ ਸਿੰਘ ਜੀ ਨੇ ਵੀ ਨੌਜਵਾਨ ਸਭਾ ਦਾ ਆਯੋਜਨ ਕੀਤਾ ਸੀ ਅਤੇ ਉਹ ਉਸ ਦੇ ਮੁਖੀ ਸੀ ਅਤੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਅੰਗਰੇਜ਼ਾਂ ਨੇ ਭਾਰਤੀਆਂ ਉਤੇ ਬਹੁਤ ਜ਼ੁਲਮ ਕੀਤੇ ਸੀ